ਇਹ ਉਹ ਤਸਵੀਰਾਂ ਹਨ ਜੋ ਕਿ ਅਸੀਂ ਆਪਣੇ ਆਪ ਦੇ ਕੈਮਰਿਆਂ ਨਾਲ ਖਿੱਚ ਸਕਦੇ ਹਾਂ ਅਤੇ ਇਨ੍ਹਾਂ ਤਸਵੀਰਾਂ ਦੇ ਵੱਖ ਵੱਖ ਸਾਈਜ ਹੁੰਦੇ ਹਨ ਜੋ ਕਿ ਐੱਚ ਡੀ ਕੈਮਰਿਆਂ ਨਾਲ ਖਿੱਚਦੇ ਹਾਂ ਇਨ੍ਹਾਂ ਤਸਵੀਰਾਂ ਨੂੰ ਅਸੀਂ ਲਗਭਗ ਕਈ ਤਰ੍ਹਾਂ ਦੇ ਐਂਗਲਾਂ ਤੋਂ ਖਿੱਚ ਸਕਦੇ ਹਾਂ ਵੱਖ ਵੱਖ ਐਂਗਲਾਂ ਤੋਂ ਖਿੱਚਣ ਨਾਲ ਇਨ੍ਹਾਂ ਦੇ ਵੱਖ ਵੱਖ ਸਾਈਜ ਵਗੈਰਾ ਹੁੰਦੇ ਹਨ ਅਸੀਂ ਇਨ੍ਹਾਂ ਤਸਵੀਰਾਂ ਨੂੰ ਆਮ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਆਮ ਸਿਨਰੀਆਂ ਵਗੈਰਾ ਜਾਂ ਲਾ ਲਓ ਵੀ ਵਿਆਹਾਂ ਸ਼ਾਦੀਆਂ ਵਿੱਚ ਲਾ ਲਓ ਵਿੱਚ ਖਿੱਚ ਸਕਦੇ ਹਾਂ ਆਮ ਫੰਕਸ਼ਨਾਂ 'ਤੇ ਖਿੱਚ ਸਕਦੇ ਹਾਂ ਪ੍ਰੋਗਰਾਮਾਂ 'ਤੇ ਖਿੱਚਦੇ ਹਾਂ ਲਗਭਗ ਕਿਸੇ ਰੈਲੀ 'ਤੇ ਖਿੱਚ ਲਈ ਰਾਜਨੀਤਿਕ ਰੈਲੀ 'ਤੇ ਖਿੱਚ ਲਈਆਂ ਇਹ ਤਸਵੀਰਾਂ ਅਸੀਂ ਆਮ ਕਿਸੇ ਵਧੀਆ ਕੈਮਰਿਆਂ ਵਗੈਰਾ ਨਾਲ ਖਿੱਚਦੇ ਹਾਂ ਇਨ੍ਹਾਂ ਤਸਵੀਰਾਂ 'ਤੇ ਅਸੀਂ ਮੰਨ ਲਓ ਸੈਜ ਬਣਾਉਣੇ ਆ ਐੱਚ ਡੀ ਫੋਟੋ ਖਿੱਚਣੀ ਹੈ ਤਾਂ ਵੱਖ ਵੱਖ ਤਰ੍ਹਾਂ ਦੇ ਸੈਜ ਵੀ ਹੁੰਦੇ ਹਨ ਵੱਖ ਵੱਖ ਤਰ੍ਹਾਂ ਦੇ ਪ੍ਰੋਗਰਾਮਾਂ ਵਿੱਚ ਵਿਆਹਾਂ ਵਿੱਚ ਤੀਆਂ ਵਿੱਚ ਜਾਂ ਕਹਿ ਲਓ ਸਿਆਸੀ ਸਟੇਜਾਂ 'ਤੇ ਜਾਂ ਤੁਸੀਂ ਕਹਿ ਲਓ ਵੀ ਆਮ ਆਪਣੇ ਪ੍ਰੋਗਰਾਮਾਂ ਵਿੱਚ ਮਰਗਾਂ ਦੇ ਭੋਗਾਂ 'ਤੇ ਜਾਂ ਕੋਈ ਹੋਰ ਅਲੱਗ ਅਲੱਗ ਤਰ੍ਹਾਂ ਦੇ ਤਰੀਕਿਆਂ ਪ੍ਰੋਗਰਾਮ ਫੰਕਸ਼ਨ ਹੁੰਦੇ ਹਨ ਜਿਨ੍ਹਾਂ ਫੰਕਸ਼ਨਾਂ ਵਿੱਚ ਅਸੀਂ ਆਪਣੇ ਆਪ ਦੇ ਕੈਮਰਿਆਂ ਨਾਲ ਇਹ ਫੋਟੋਆਂ ਨੂੰ ਤਸਵੀਰਾਂ ਨੂੰ ਖਿੱਚ ਕੇ ਆਮ ਪਬਲਿਕ ਨੂੰ ਦੇ ਸਕਦੇ ਹਾਂ ਅਸੀਂ ਇੱਕ ਸਟੂਡੀਓ ਹੋਣ ਦੇ ਨਾਤੇ ਫੋਟੋਗ੍ਰਾਫਰ ਹੋਣ ਦੇ ਨਾਤੇ ਇਨ੍ਹਾਂ ਤਸਵੀਰਾਂ ਨੂੰ ਆਪਣੇ ਹੀ ਸੋਪ 'ਤੇ ਕਹਿ ਲਓ ਆਪਣੀ ਲੈਬ ਦੇ ਵਿੱਚ ਕਹਿ ਲਓ ਅਸੀਂ ਬਣਾ ਸਕਦੇ ਹਾਂ ਪ੍ਰਿੰਟਰਾਂ ਰਾਹੀਂ ਕੱਢ ਸਕਦੇ ਹਾਂ ਇਨ੍ਹਾਂ ਤਸਵੀਰਾਂ ਵਿੱਚ ਅਸੀਂ ਆਮ ਚੰਗਾ ਡਿਜੀਟਲ ਪ੍ਰਿੰਟ ਅਤੇ ਚੰਗਾ ਪੇਪਰ ਲਾ ਕੇ ਕੱਢਦੇ ਹਾਂ ਅਸੀਂ ਤਸਵੀਰਾਂ ਨੂੰ ਆਮ ਤੌਰ 'ਤੇ ਹੱਸਦੀਆਂ ਤਸਵੀਰਾਂ ਵਧੀਆ ਚਿਹਰੇ ਬਣਾ ਕੇ ਪੇਸ਼ ਕਰਦੇ ਹਾਂ ਇਨ੍ਹਾਂ ਤਸਵੀਰਾਂ ਵਿੱਚ ਬੱਚੇ ਬਜ਼ੁਰਗ ਸਕੂਲਾਂ ਦੀਆਂ ਗਰੁੱਪ ਫੋਟੋਆਂ ਜਾਂ ਲਾ ਲਓ ਵੀ ਆਮ ਕਿਸੇ ਜਾਨਵਰ ਦੀ ਖਿੱਚਣੀ ਹੈ ਕਿਸੇ ਸਿਨਰੀ ਦੀ ਫੋਟੋ ਖਿੱਚਣੀ ਹੈ ਜਾਂ ਕਿਸੇ ਹਾਊਸ ਵਧੀਆ ਹਾਊਸ ਪਾਇਆ ਹੋਇਆ ਹੈਗਾ ਉਸਦੀ ਫੋਟੋ ਖਿੱਚਣੀ ਹੈ ਤਾਂ ਇਹ ਅਜਿਹੇ ਅਲੱਗ ਅਲੱਗ ਤਰੀਕਿਆਂ ਨਾਲ ਅਸੀਂ ਇਨ੍ਹਾਂ ਤਸਵੀਰਾਂ ਨੂੰ ਪੇਸ਼ ਕਰਦੇ ਹਾਂ ਅਤੇ ਅ ਹੋਰ ਵੀ ਕਈ ਤਰੀਕੇ ਹਨ ਫੋਟੋਆਂ ਖਿੱਚਣ ਦੇ ਜਾਂ ਤਸਵੀਰਾਂ ਖਿੱਚਣ ਦੇ ਅਸੀਂ ਇਹ ਤਸਵੀਰਾਂ ਨੂੰ ਆਮ ਖਿੱਚ ਕੇ ਪੇਪਰਾਂ ਵਿੱਚ ਅਖ਼ਬਾਰਾਂ ਵਿੱਚ ਵੀ ਛਾਪ ਦਿੰਦੇ ਹਾਂ ਲਗਭਗ ਸਿਨਰੀਆਂ ਬਣਦੀਆਂ ਆਮ ਮੰਨ ਲਓ ਸਿਆਸੀ ਲੀਡਰ ਆਉਂਦੇ ਨੇ ਉਨ੍ਹਾਂ ਦੀਆਂ ਫੋਟੋਆਂ ਕੋਈ ਧਰਨਾ ਲੱਗ ਗਿਆ ਉਨ੍ਹਾਂ ਦੀਆਂ ਫੋਟੋਆਂ ਵੱਖ ਵੱਖ ਤਰ੍ਹਾਂ ਦੇ ਐਂਗਲਾਂ ਤੋਂ ਇਹ ਫੋਟੋਆਂ ਅਸੀਂ ਖਿੱਚਦੇ ਹਾਂ ਇਨ੍ਹਾਂ ਫੋਟੋਆਂ ਨੂੰ ਅਸੀਂ ਲਗਭਗ ਆਮ ਜਨਤਾ ਰਾਹੀਂ ਆਮ ਦੁਕਾਨਦਾਰਾਂ 'ਤੇ ਜਾਂ ਲਾ ਲਓ ਵੀ ਪੇਸ਼ ਕਰ ਦਿੰਦੇ ਹਾਂ